ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਤਾਰਾਂ ਸੌ ਅੱਸੀ ਈਸਵੀ ਵਿੱਚ ਗੁੱਜਰਾਂਵਾਲਾ ਪਾਕਿਸਤਾਨ ਮਹਾਂ ਮਹਾਰਾਜਾ ਮਹਾਂ ਸਿੰਘ ਦੇ ਘਰ ਹੋਇਆ ਉਸ ਸਮੇਂ ਪੰਜਾਬ ਵਿੱਚ ਸਿੱਖਾਂ ਅਤੇ ਅਫਗਾਨੀਆਂ ਦਾ ਰਾਜ ਸੀ ਜਿਹਨਾਂ ਨੇ ਪੂਰੇ ਇਲਾਕੇ ਨੂੰ ਵੱਖ ਵੱਖ ਮਿਸਲਾਂ ਵਿੱਚ ਵੰਡਿਆ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਰਾਜਾ ਮਹਾਂ ਸਿੰਘ ਸ਼ੁਕਰਚਕੀਆ ਮਿਸਲ ਦੇ ਕਮਾਂਡਰ ਸੀ ਪੱਛਮੀ ਪੰਜਾਬ ਵਿੱਚ ਸਥਿਤ ਇਹ ਇਲਾਕਾ ਮੁੱਖ ਤੌਰ 'ਤੇ ਗੁੱਜਰਾਂਵਾਲਾ ਵਾਲਾ ਵਿੱਚ ਸੀ ਛੋਟੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਦੀ ਰੋਸ਼ਨੀ ਚੇਚਕ ਕਰਕੇ ਚਲੀ ਗਈ ਸੀ ਬਾਰਾਂ ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿਤਾ ਮਹਾਰਾਜਾ ਮਹਾਂ ਸਿੰਘ ਦਾ ਦੇਹਾਂਤ ਹੋ ਗਿਆ ਅਤੇ ਸਾਰੇ ਰਾਜ ਪਾਠ ਦਾ ਬੋਝ ਮਹਾਰਾਜਾ ਰਣਜੀਤ ਸਿੰਘ ਦੇ ਮੋਢਿਆਂ 'ਤੇ ਆ ਗਿਆ ਅਠਾਰਾਂ ਸੌ ਇੱਕ ਈਸਵੀ ਵਿੱਚ ਰਣਜੀਤ ਸਿੰਘ ਮਹਾਰਾਜਾ ਬਣੇ ਉਹਨਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਫਿਰ ਅੰਮ੍ਰਿਤਸਰ ਵੱਲ ਗਏ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨੀਆਂ ਖਿਲਾਫ ਕਈ ਲੜਾਈਆਂ ਲੜੀਆਂ ਉਹਨਾਂ ਨੇ ਪਹਿਲੀ ਭਾਰਤੀ ਸਿੱਖ ਖਾਲਸਾ ਸੈਨਾ ਦਾ ਗਠਨ ਕੀਤਾ ਉਹਨਾਂ ਦੇ ਰਾਜ ਵਿੱਚ ਪੰਜਾਬ ਬਹੁਤ ਸ਼ਕਤੀਸ਼ਾਲੀ ਸੂਬਾ ਸੀ ਉਹਨਾਂ ਦੀ ਬਣਾਈ ਸਿੱਖ ਖਾਲਸਾ ਸੈਨਾ ਸੈਨਾ ਨੇ ਹੀ ਪੰਜਾਬ ਨੂੰ ਬ੍ਰਿਟੇਨ ਤੋਂ ਕਈ ਸਾਲ ਰੱਖਿਆ ਕੀਤੀ ਸੀ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਸਿਰਫ ਪੰਜਾਬ ਹੀ ਇੱਕ ਅਜਿਹਾ ਸੂਬਾ ਸੀ ਜਿਸ 'ਤੇ ਅੰਗਰੇਜ਼ਾਂ ਦਾ ਕਬਜ਼ਾ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਖੁਦ ਅਨਪੜ੍ਹ ਸਨ ਪਰ ਉਹਨਾਂ ਨੇ ਸਿੱਖਿਆ ਅਤੇ ਕਲਾ ਨੂੰ ਲੋਕਾਂ ਵਿੱਚ ਪ੍ਰਚਾਰ ਕੀਤਾ ਉਹਨਾਂ ਨੇ ਪੰਜਾਬ ਵਿੱਚ ਕਾਨੂੰਨ ਦੀ ਸਥਾਪਨਾ ਕੀਤੀ ਪਰ ਕਦੇ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਉਹਨਾਂ ਦਾ ਸੂਬਾ ਧਰਮ ਨਿਰਪੱਖ ਸੀ ਉਹਨਾਂ ਨੇ ਲੋਕਾਂ ਨੂੰ ਵਸੂਲੇ ਜਾਂਦੇ ਕਰਾਂ 'ਤੇ ਵੀ ਰੋਕ ਲਗਾਈ ਕਦੇ ਕਿਸੇ ਨੂੰ ਕੋਈ ਧਰਮ ਅਪਣਾਉਣ ਲਈ ਮਜਬੂਰ ਨਹੀਂ ਕੀਤਾ ਉਹਨਾਂ ਨੇ ਅੰਮਿਰ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਸੰਗਮਰਮਰ ਲਗਵਾਇਆ ਅਤੇ ਸੋਨਾ ਮੜ੍ਹਵਾਇਆ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦੀ ਸ਼ਾਨ ਸੀ